ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਠੀਕ ਆ ਸਰ ਸ ਸ਼ਰਮਾਸ ਟਰੈਵਲ ਤੋਂ ਬੋਲਦੇ ਹੋ ਸਰ ਸਰ ਐਚੂਅਲੀ ਮੈਂ ਜਾਣਾ ਸੀਗਾ ਬਠਿੰਡਾ ਟ੍ਰੇਨ ਫੜਨੀ ਸੀਗੀ ਮੈਂ ਅਗਾਂਹ ਜਾਣਾ ਸੀ ਰਿਸ਼ਤੇਦਾਰੀ 'ਚ ਸਰ ਅਤੇ ਉਹ ਤੁਹਾਡੇ ਸਰ ਉਹ ਡਰਾਈਵਰ ਨੇ ਨਾ ਲੇਟ ਕਰਾ ਤਾ ਅਗਾਂਹ ਵੀ ਮੈਂ ਰਿਸ਼ਤੇਦਾਰਾਂ 'ਚ ਨਹੀਂ ਪਹੁੰਚ ਸਕਿਆ ਜਿੱਥੇ ਮਿਲਣਾ ਸੀਗਾ ਅਤੇ ਅੱਧਾ ਘੰਟਾ ਮੇਰੀ ਟ੍ਰੇਨ ਛੁੱਟ ਗਈ ਸਰ ਅਤੇ ਡਰਾਈਵਰ ਉੱਤੋਂ ਡਰਾਈਵਰ ਵੀ ਨਹੀਂ ਸਰ ਮੰਨ ਰਿਹਾ ਸਰ ਗਰਮੀ ਸੀ ਸਰ ਬਹੁਤ ਜ਼ਿਆਦਾ ਅਤੇ ਅਗਾਂਹ ਵੀ ਮੈਂ ਸਮਝ ਖੱਜਰ ਖੁਆਰ ਹੋਇਆ ਅਤੇ ਮੈਨੂੰ ਸਰ ਮੇਰਾ ਉਹ ਫੰਡ ਦਿੱਤਾ ਜਾਵੇ ਸਰ ਸਤਿ ਸ਼੍ਰੀ ਅਕਾਲ